ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਨੂੰ ਆਪਣੀ ਫਰੈਂਡ ਤੋਂ ਤੁਹਾਡਾ ਨੰਬਰ ਮਿਲਿਆ ਹਾਂਜੀ ਅਸੀਂ ਬਠਿੰਡਾ ਤੋਂ ਪਟਿਆਲਾ ਆਏ ਹੋਏ ਹਾਂ ਸਰ ਸਾਨੂੰ ਇੱਥੇ ਸ਼ੋਪਿੰਗ ਕਰਨੀ ਆ ਪਰ ਅਸੀਂ ਕੱਪੜੇ ਵਗੈਰਾ ਵੀ ਖਰੀਦਣੇ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਪਟਿਆਲਾ ਦੇ ਵਿੱਚ ਸ਼ੋਪਿੰਗ ਲਈ ਕਿਹੜੇ ਕਿਹੜੇ ਵਧੀਆ ਜਗ੍ਹਾ ਹਾਂਜੀ ਅੱਛਾ ਜੀ ਉੱਥੋਂ ਸਰ ਕੱਪੜੇ ਜੁੱਤੀਆਂ ਸਭ ਕੁਛ ਮਿਲ ਜਾਏਗਾ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹੈ ਸਰ ਇੱਥੇ ਪਟਿਆਲਾ ਵਿੱਚ ਸਭ ਤੋਂ ਫੇਮਸ ਕੀ ਮਿਲ ਰਿਹਾ ਸਰ ਮਾਰਕੀਟ ਦਾ

ਠੀਕ ਹੈ ਜੀ ਓਕੇ ਸਰ ਥੈਂਕ ਯੂ ਜੀ ਜਾਣਕਾਰੀ ਲਈ ਸਰ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਦੋ ਦਿਨ ਛੁੱਟੀਆਂ ਆ ਰਹੀਆਂ ਨੇ ਅੱਗੇ ਕੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਇਹ ਸਾਰੀ ਸ਼ੋਪਿੰਗ ਕਰਵਾਉਣ ਮੈਨੂੰ ਹਾਂਜੀ ਠੀਕ ਹੈ ਸਰ ਓਕੇ ਜੀ ਥੈਂਕ ਯੂ ਜੀ